ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਲੱਗ ਤੋਂ ਅਲੱਗ ਤਰੀਕੇ ਦੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ ਜਿਵੇਂ ਕਿ ਡੇਰੀ ਦਾ ਕੰਮ ਹੋ ਗਿਆ ਦੁੱਧ ਦਾ ਕੰਮ ਵਿੱਚ ਆਪਾਂ ਦਹੀਂ ਦਾ ਸਮਾਨ ਆਈਸ ਕ੍ਰੀਮ ਵਰਗੀਆਂ ਚੀਜ਼ਾਂ ਨੂੰ ਸ਼ਾਮਿਲ ਕਰਦੇ ਹਾਂ ਅਤੇ ਜੇ ਅਸੀਂ ਦੂਸਰੇ ਗੱਲ ਕੀਤੀ ਜਾਵੇ ਤਾਂ ਕਰਿਆਨੇ ਦਾ ਦ ਕਰਿਆਨੇ ਦੀ ਚੀਜ਼ਾਂ ਵੀ ਅਸੀਂ ਰੱਖ ਸਕਦੇ ਹਾਂ ਆਟੇ ਦੀ ਚੱਕੀ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਪਿੰਡਾਂ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਹੈ ਯੂਜ਼ ਅਤੇ ਵਰਤੋਂ ਕੀਤੀ ਜਾਂਦੀ ਹੈ ਅਤੇ ਤੁਸੀਂ ਆਰਾਮ ਨਾਲ ਹੀ ਆਟਾ ਪਿਸਵਾ ਆ ਵਾਸਤੇ ਜਾ ਸਕਦੇ ਹੋ ਤਾਂ ਤੁਸੀਂ ਆਪਣੇ ਹਰ ਇੱਕ ਕੰਮ ਵਾਸਤੇ ਇ ਇੱਧਰ ਉੱਧਰ ਜਾਣ ਨੂੰ ਭੱਟਕਣਾ ਨਹੀਂ ਪੈਂਦਾ ਇਸ ਤਰੀਕੇ ਨਾਲ ਅਸਾਂ ਨੂੰ ਆਪਣਾ ਕਾਰੋਬਾਰ ਦੇਖਣਾ ਪੈਂਦਾ ਹੈ ਇਸ ਤੋਂ ਇਲਾਵਾ ਅਸੀਂ ਸਟੇਸ਼ਨਰੀ ਦਾ ਸਮਾਨ ਬਥੇਰਾ ਲਾ ਸਕਦੇ ਹਾਂ ਹਰ ਇੱਕ ਸਟੇਸ਼ਨਰੀ ਦਾ ਸਮਾਨ ਦੇ ਵਿੱਚ ਅਸੀਂ ਕਾਪੀਆਂ ਪੈਨ ਬੁੱਕਸ ਕਿਤਾਬਾਂ ਵਰਗੀਆਂ ਚੀਜ਼ਾਂ ਨੂੰ ਐਡ ਕਰਕੇ ਉਹਨਾਂ ਨੂੰ ਆਪਣਾ ਕਾਰੋਬਾਰ ਤਿਆਰ ਕਰ ਸਕਦੇ ਹਾਂ ਕਈ ਲੋਕ ਤਾਂ ਆਪਣੀ ਅਲੱਗ ਤੋਂ ਅਲੱਗ ਫੈਕਟਰੀਆਂ ਵੀ ਲਾ ਲੈਂਦੇ ਹਨ ਜੇ ਅਤੇ ਜ਼ਿਲ੍ਹੇ ਦੇ ਵਿੱਚ ਹੋਣ ਤਾਂ ਫੈਕਟਰੀਆਂ ਲਾ ਸਕਦੇ ਹਨ ਅਤੇ ਅਲੱਗ ਤੋਂ ਅਲੱਗ ਕਾਰੋਬਾਰ ਵਧਾ ਵੀ ਸਕਦੇ ਹਾਂ ਕਈ ਲੋਕਾਂ ਨੇ ਤਾਂ ਆਪਣੇ ਇੱਕ ਛੋਟੀ ਜੀ ਸਵੀਟਸ ਜਾਂ ਤਾਂ ਖਾਣ ਪੀਣ ਦੀ ਦੁਕਾਨ ਵੀ ਦਾ ਵੀ ਇੱਕ ਕਾਰੋਬਾਰ ਚਲਾਇਆ ਹੈ